ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕ ਹੈ ਮੈਂ ਐਮਾਜੋਂਨ ਤੋਂ ਇੱਕ ਕਰੋਕਰੀ ਸੈੱਟ ਔਡਰ ਕੀਤਾ ਸੀ ਇਹ ਔਡਰ ਮੈਂ ਬਾਈ ਦੋ ਚੌਵੀ ਨੂੰ ਕੀਤਾ ਸੀ ਅਤੇ ਇਹ ਔਡਰ ਮੈਨੂੰ ਚੌਵੀ ਤਿੰਨ ਚੌਵੀ ਨੂੰ ਮਿਲਿਆ ਹੈ ਕਰੋਕਰੀ ਸੈੱਟ ਦੇ ਵਿੱਚ ਅੱਠ ਪਲੇਟਾਂ ਅੱਠ ਚਮਚੇ ਅਤੇ ਅੱਠ ਹੀ ਬੋਲ ਸੀ ਪਰ ਪਰ ਜੋ ਡਿਜ਼ਾਇਨ ਮੈਨੂੰ ਐਮਾਜੋਨ ਦੇ ਉੱਪਰ ਦੇਖਣ ਨੂੰ ਮਿਲਿਆ ਉਹ ਡਿਜ਼ਾਇਨ ਦਾ ਇਹ ਕਰੋਕਰੀ ਸੈੱਟ ਬਿਲਕੁਲ ਵੀ ਨਹੀਂ ਸੀ ਇਹ ਸੈੱਟ ਇਸ ਸੈੱਟ ਵਿੱਚੋਂ ਪਲੇਟਸ ਵੀ ਟੁੱਟੀਆਂ ਹੋਈਆਂ ਸਨ ਅਤੇ ਬੋਲਸ ਵੀ ਜਿਹੜੇ ਟੁੱਟੇ ਹੋਏ ਸਨ ਅਤੇ ਇਹਦੀ ਜਿਹੜੀ ਪੈਕਿੰਗ ਹੈ ਉਹ ਵੀ ਕੁਝ ਖਾਸ ਨਹੀਂ ਸੀ ਇੱਦਾਂ ਲੱਗਦਾ ਪਿਆ ਸੀ ਜਿੱਦਾਂ ਸੈਕਿੰਡ ਹੈਂਡ ਕਿਸੇ ਨੇ ਕਿਸੇ ਨੇ ਇੱਦਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਕਿ ਸੈਕਿੰਡ ਹੈਂਡ ਕਰੋਕਰੀ ਸੈੱਟ ਆ ਗਿਆ ਹੋਏ ਇਹ ਸੈੱਟ ਮੈਂ ਆਪਣੀ ਸਿਸਟਰ ਨੂੰ ਗਿਫਟ ਕੀਤਾ ਸੀ ਉਹਦੇ ਉਹਨਾਂ ਦੇ ਫੰਕਸ਼ਨ ਪਾਰਟੀ ਦੇ ਉੱਪਰ ਅਤੇ ਜਦ ਉਹਨਾਂ ਨੇ ਖੋਲ੍ਹ ਕੇ ਦੇਖਿਆ ਤਾਂ ਵਿੱਚੋਂ ਸਮਾਨ ਟੁੱਟਿਆ ਹੋਇਆ ਸੀ ਉੱਥੇ ਕਿ ਜਦਕਿ ਉੱਥੇ ਕਾਫੀ ਸਾਰੇ ਲੋਕ ਆਏ ਹੋਏ ਸਨ ਸੋ ਕਿਰਪਾ ਕਰਕੇ ਮੈਂ ਇਹ ਬੇਨਤੀ ਕਰਦੀ ਹਾਂ ਤੁਹਾਡੇ ਅੱਗੇ ਕਿ ਇਹ ਕਰੋਕਰੀ ਸੈੱਟ ਮੈਂ ਤੁਹਾਨੂੰ ਵਾਪਸ ਕਰ ਦਾਂਗੀ ਤਾਂ ਤੁਸੀਂ ਮੈਨੂੰ ਇਹਦੀ ਜਗ੍ਹਾ ਪੂਰਾ ਸਹੀ ਡਿਜ਼ਾਇਨ ਵਾਲਾ ਜੋ ਕਿ ਮੈਂ ਦੇਖਿਆ ਸੀ ਉਹ ਕਰੋਕਰੀ ਸੈੱਟ ਮੇਰੇ ਘਰ ਪਹੁੰਚਾ ਦਿੱਤਾ ਜਾਵੇ ਮੇਰੀ ਇਹੀ ਤੁਹਾਨੂੰ ਬੇਨਤੀ ਹੈ ਥੈਂਕ ਯੂ